ਸਤਿ ਸ਼੍ਰੀ ਅਕਾਲ ਜੀ ਜੀ ਮੈਂ ਤੁਹਾਡੇ ਐਮਾਜ਼ੋਨ ਤੋਂ ਇੱਕ ਕਰੀਮ ਆਡਰ ਕੀਤੀ ਸੀ ਆਪਣੇ ਚਿਹਰੇ ਵਾਸਤੇ ਤਾਂ ਕਿ ਮੇਰਾ ਜਿਹੜਾ ਰੰਗ ਹੈਗਾ ਉਹ ਅੱਗੇ ਨਾਲੋਂ ਸਾਫ ਹੋ ਜਾਵੇ ਬਟ ਤੁਹਾਡੀ ਕਰੀਮ ਦੀ ਵਰਤੋਂ ਦੇ ਨਾਲ ਮੇਰਾ ਜਿਹੜਾ ਚਿਹਰਾ ਹੈ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਜਿਹਤੇ ਮੇਰੇ ਅੱਖਾਂ ਦੇ ਨੇੜੇ ਝੁਰੜੀਆਂ ਵੀ ਪੈਣ ਲੱਗ ਗਈਆਂ ਹਨ ਅਤੇ ਪਿੰਪਲਜ਼ ਵੀ ਹੋਣ ਲੱਗ ਗਏ ਨੇ ਅਤੇ ਕਾਫ਼ੀ ਡਾਰਕਸਪੋਸ ਜਿਹੜੇ ਹੈ ਉਹਨੇ ਛੱਡ ਦਿੱਤੇ ਹੈ ਉਹਨੂੰ ਲਗਾਉਣ ਤੋਂ ਬਾਅਦ ਨਾ ਲਗਾਤਾਰ ਮੇਰੇ ਫ਼ੇਸ 'ਤੇ ਜਲਣ ਹੁੰਦੀ ਰਹਿੰਦੀ ਹੈ ਅਤੇ ਇੰਨੀ ਜ਼ਿਆਦਾ ਸਕਿੱਨ 'ਤੇ ਪਰੋਬਲਮ ਆ ਗਈ ਕਿ ਮੈਨੂੰ ਡਾਕਟਰ ਨੂੰ ਦਿਖਾਉਣਾ ਪਿਆ ਜਿਸ ਕਰਕੇ ਡਾਕਟਰ ਨੇ ਹੋਰ ਮੈਡੀਸਨਜ਼ ਲਿਖ ਦਿੱਤੀਆਂ ਤੁਹਾਡੀ ਕਰੀਮ ਲਗਾਉਣ ਨਾਲ ਮੇਰੀ ਪੈਸੇ ਦੀ ਤਾਂ ਵੇਸਟੇਜ਼ ਹੋਈ ਹੀ ਹੋਈ ਹੈ ਬਰਬਾਦੀ ਹੋਈ ਹੈ ਨਾਲ ਦੇ ਨਾਲ ਮੈਨੂੰ ਜਿਹੜਾ ਡਾਕਟਰ ਨੂੰ ਦੇਣਾ ਪਿਆ ਉਹ ਵੀ ਬਹੁਤ ਜ਼ਿਆਦਾ ਮੇਰਾ ਖਰਚਾ ਹੋਇਆ ਹੈ ਧੰਨਵਾਦ ਅਗਲੇ ਤੋਂ ਇਸ ਵਾਰ ਤੋਂ ਜ਼ਰੂਰ ਧਿਆਨ ਰੱਖਿਓ